ਹੈਲੋ ਤੁਸੀਂ ਜੈ ਮਾਤਾ ਇਲੈਕਟ੍ਰੀਸ਼ਨਸ ਤੋਂ ਗੱਲ ਕਰ ਰਹੇ ਹੋ ਅੱਛਾ ਉਹ ਨਾ ਥੋ ਵੀਰੇ ਸਾਡੇ ਨਾ ਮਤਲਬ ਫਰਿਜ 'ਤੇ ਨਾ ਵੋਸ਼ਿੰਗ ਮਸ਼ੀਨ ਦਾ ਸਟੈਪਲਾਈਜ਼ਰ ਖਰਾਬ ਹੋ ਗਿਆ ਅਤੇ ਉਹ ਤੁਸੀਂ ਸਹੀ ਕਰਨਾ ਹੈ ਅਤੇ ਮੈਨੂੰ ਐਵੈਂ ਦੱਸੋ ਕਦੋਂ ਤੱਕ ਆ ਸਕਦੇ ਹੋ ਕੱਲ੍ਹ ਸ਼ਾਮ ਨਹੀਂ ਨਹੀਂ ਬਹੁਤ ਲੇਟ ਹੋ ਜਾਏਗਾ ਕਲ੍ਹ ਸ਼ਾਮ ਤੱਕ ਤਾਂ ਨਹੀਂ ਤੁਸੀਂ ਕਲ੍ਹ ਸੂਬਹ ਤੱਕ ਨਹੀਂ ਆ ਸਕਦੇ ਅੱਛਾ ਉਹ ਨਾ ਫਿਰ ਕਿਉਂਕਿ ਲਾਈਟ ਦਾ ਮਤਲਬ ਵੱਧ ਘੱਟ ਤੁਹਾਨੂੰ ਪਤਾ ਤੁਹਾਨੂੰ ਵੀ ਪਤਾ ਵੀ ਆ ਜਾ ਰਹੀ ਹੈ ਵਾਰੀ ਵਾਰੀ ਅਤੇ ਨਾ ਵੱਧ ਘੱਟ ਆ ਰਹੀ ਆ ਕਦੇ ਬਹੁਤ ਜ਼ਿਆਦਾ ਤੇਜ਼ ਆ ਜਾਂਦੀ ਆ ਅਤੇ ਕਦੇ ਆਉਂਦੀ ਨਹੀਂ ਅਤੇ ਉਹਦੇ ਕਰਕੇ ਨਾ ਫਿਰ ਇਹਨਾਂ ਚੀਜ਼ਾਂ ਦੇ ਸੜ੍ਹਨ ਦਾ ਬੜਾ ਜ਼ਿਆਦਾ ਡਰ ਹੈ ਤੁਹਾਨੂੰ ਪਤਾ ਫ੍ਰਿਜ ਤਾਂ ਚੌਵੀ ਘੰਟਾ ਚੱਲਣ ਵਾਲੀ ਚੀਜ਼ ਹੈ ਅਤੇ ਵੋਸ਼ਿੰਗ ਮਸ਼ੀਨ ਦੇ ਪਲੱਗ 'ਚੋਂ ਮੈਨੂੰ ਐਵੈਂ ਸਮੈਲ ਜਿਹੀ ਆ ਰਹੀ ਸੀ ਜਿਵੇਂ ਤਾਰਾਂ ਮਤਲਬ ਜਲਨ ਦੀ ਸਮੈਲ ਆ ਰਹੀ ਸੀ ਅਤੇ ਮੈਂ ਤੁਹਾਨੂੰ ਉਹ ਕਰ ਹੁਣ ਉਸ ਤੋਂ ਬਾਅਦ ਵਰਤਿਆ ਹੀ ਨਹੀਂ ਉਵੇਂ ਸਾਈਡ 'ਚ ਰੱਖ ਰੱਖੇ ਵੀ ਤੁਸੀਂ ਆਉਗੇ ਤਾਂ ਤੁਹਾਨੂੰ ਦਿਖਾਉਂਗੀ ਮੈਂ ਫਿਰ ਉਹ ਨਾ ਪਿਛਲੀ ਵਾਰ ਵੀ ਕਰਵਾਇਆ ਸੀ ਤੁਹਾਡੇ ਤੋਂ ਸੇਮ ਦਿੱਕਤ ਸੀ ਅਤੇ ਤੁਸੀਂ ਉਹ ਫਿਰ ਹੁਣ ਫਿਰ ਖਰਾਬ ਹੋ ਗਿਆ ਉਹ ਨਹੀਂ ਪਿਛਲੀ ਵਾਰ ਨਾਲੇ ਵੀ ਪੈਸੇ ਵੀ ਤੁਸੀਂ ਵਾਹਵਾ ਹੀ ਮਤਲਬ ਲੈ ਲਏ ਸੀ ਪੈਸੇ ਸਮਾਂ ਮਤਲਬ ਉਹ ਠੀਕ ਸਮਾਨ ਵੀ ਤੁਸੀਂ ਇੰਨਾ ਵਧੀਆ ਨਹੀਂ ਪਾਇਆ ਅਤੇ ਮੈਂ ਦੇਖਿਆ ਤੁਸੀਂ ਨਾ ਕਈ ਵਾਰੀ ਆਪ ਨਹੀਂ ਆਉਂਦੇ ਅਤੇ ਨਾ ਉਹ ਆਪਦੇ ਨਾਲ ਵਾਲੇ ਅਸਿਸਟੈਂਟ ਨੂੰ ਭੇਜ ਦਿੰਦੇ ਹੋ ਉਹਨੂੰ ਇੰਨੀ ਜਾਣਕਾਰੀ ਹੁੰਦੀ ਨਹੀਂ ਅਤੇ ਫਿਰ ਤੁਹਾਨੂੰ ਪਤਾ ਉਹ ਚੀਜ਼ ਵਾਰੀ ਵਾਰੀ ਖਰਾਬ ਹੋ ਜਾਂਦੀ ਹੈ ਆਜਾ ਪੈਸੇ ਭਾਵੇ ਤੁਸੀਂ ਨਾ ਜ਼ਿਆਦਾ ਲੈ ਲਿਓ ਜੀ ਪਰ ਨਾ ਤੁਸੀਂ ਸਮਾਨ ਥੋੜ੍ਹਾ ਵਧੀਆ ਪਾ ਕੇ ਅਤੇ ਥੋੜ੍ਹਾ ਕੋਸ਼ਿਸ਼ ਕਰੋ ਜਲਦੀ ਆ ਕੇ ਉਹ ਸਹੀ ਕਰ ਦਿਓ ਮੈਨੂੰ ਡਰ ਹੈ ਫ੍ਰਿਜ ਨਾ ਮਤਲਬ ਪਲੱਗ ਸੜ੍ਹ ਜਾਏ ਉਹਦਾ ਅਤੇ ਫ੍ਰਿਜ ਤਾਂ ਤੁਹਾਨੂੰ ਪਤਾ ਬੰਦ ਕੀਤੇ ਬਿਨਾਂ ਜਮਾਂ ਨਹੀਂ ਸਰਨਾ ਓਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ